ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਇੱਥੇ ਨਾ ਸੰਨੀ ਇਨਕਲੇਵ 'ਚ ਹੈ ਡਾਕਟਰ ਮਾਨ ਕਲੀਨਿਕ ਹੈ ਜੀ ਉੱਥੇ ਹਾਂ ਸਾਰੀ ਡੋਗ ਦੀ ਅਸੈਸਰੀ ਫੂਡ ਅਤੇ ਗਰੋਮਿੰਗ ਅਤੇ ਬਾਫੀ ਵਗੈਰਾ ਸਾਰੀ ਫੈਸਿਲਿਟੀਸ ਅਵੇਲੇਬਲ ਹੈ ਅਤੇ ਜੇ ਤੁਸੀਂ ਜਾਣਾ ਹੋਇਆ ਪਰ ਦਸ ਤੋਂ ਛੇ ਦੇ ਵਿੱਚ ਵਿੱਚ ਜਾਇਓ ਜੀ ਉਸ ਟਾਈਮ ਇਹ ਓਪਨ ਹੁੰਦਾ ਜੀ ਉਹ ਬਾਕੀ ਉੱਥੇ ਸਾਰੀ ਮੈਡੀਕਲ ਫੈਸਿਲਿਟੀਸ ਵੀ ਅਵੇਲੇਬਲ ਹੈ ਸਾਡੇ ਸਾਰੇ ਆਪਣੇ ਕੁੱਤਿਆਂ ਦਾ ਵੀ ਸਮਾਨ ਉੱਥੋਂ ਤੋਂ ਹੀ ਆਉਂਦਾ ਜੀ ਉਦਾਂ ਡਾਕਟਰ ਵਧੀਆ ਜੀ ਉੱਥੇ ਨਹੀਂ ਭਾਅ ਜੀ ਸੰਡੇ ਨੂੰ ਨਹੀਂ ਓਪਨ ਹੁੰਦਾ ਓਨਲੀ ਵਰਕਿੰਗ ਡੇਅਸ 'ਚ ਹਾਂਜੀ ਬਾਕੀ ਰੇਟ ਵਗੈਰਾ ਵੀ ਠੀਕ ਹੈ ਜੀ ਉਹਨਾਂ ਦਾ ਕੋਈ ਜ਼ਿਆਦਾ ਨਹੀਂ ਹੈਗਾ ਐਨਾ ਸਹੀ ਹੈ ਅਤੇ ਉਦਾਂ ਡਾਕਟਰ ਵੀ ਵਧੀਆ ਵਧੀਆ ਹੈ ਜੀ ਹਾਂਜੀ ਠੀਕ ਹੈ ਭਾਅ ਜੀ